ਭੰਗੜਾ ਐਰੋਬਿਕਸ ਹੋਰ ਡਾਂਸ ਅਧਾਰਿਤ ਵਰਕਆਊਟ ਰੂਪਾਂ ਤੋਂ ਵੱਖਰਾ ਹੈ ਇਹ ਸਾਡੀ ਮਾਂ ਬੋਲੀ ਵਿੱਚ ਗੀਤਾਂ 'ਤੇ ਅਧਾਰਿਤ ਹੁੰਦਾ ਹੈ ਇਹ ਗੀਤ ਸੁਣ ਕੇ ਸਾਡੇ ਮਨ ਆਪਣੇ ਆਪ ਨੱਚਣ ਨੂੰ ਕਰਦੇ ਹਨ ਅਤੇ ਇਨ੍ਹਾਂ ਨਾਲ ਸਾਡੀ ਐਕਸਰਸਾਇਜ਼ ਵੀ ਹੋ ਜਾਂਦੀ ਹੈ ਭੰਗੜੇ ਵਾਲੇ ਗੀਤ ਜਿਵੇਂ ਕਿ ਸਿੱਧੂ ਮੂਸੇ ਵਾਲਾ ਕਮਲ ਹੀਰ ਮਨਮੋਹਨ ਵਾਰਿਸ ਗੁਰਦਾਸ ਮਾਨ ਦਿਲਜੀਤ ਦੋਸਾਂਝ ਗਿੱਪੀ ਗਰੇਵਾਲ ਕਮਲ ਹੀਰ ਵਰਗੇ ਵੱਡੇ ਵੱਡੇ ਸਿੰਗਰਾਂ ਦੇ ਗਾਣੇ ਸੁਣ ਕੇ ਨੱਚਣ ਨੂੰ ਬਹੁਤ ਮਨ ਕਰਦਾ ਹੈ ਅਤੇ ਬੱਚੇ ਬੁੱਢੇ ਵੀ ਇੰਜੋਆਏ ਕਰਦੇ ਹਨ ਅਸੀਂ ਸਾਰੇ ਵਧੀਆ ਮਾਹੌਲ ਬਣਾ ਕੇ ਗਿੱਧਾ ਕਰ ਸਕਦੇ ਹਾਂ ਘਰ ਕਰਦੇ ਹਾਂ ਇਸ ਨਾਲ ਵਧੀਆ ਮਨ ਪ੍ਰਚਾਵਾ ਵੀ ਹੁੰਦਾ ਹੈ ਨਾਲੇ ਟਾਈਮ ਪਾਸ ਹੁੰਦਾ ਹੈ ਵਧੀਆ ਨਾਲੇ ਐਕਸਰਸਾਈਜ਼ ਹੋ ਜਾਂਦੀ ਹੈ